ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਪਿਛਲੇ ਮਹੀਨੇ ਤੋਂ ਤੁਹਾਡੀ ਫ਼ਰਮ ਤੋਂ ਇੱਕ ਸ਼ੈਂਪੂ ਖਰੀਦਿਆ ਸੀ ਜਿਹੜਾ ਕਿ ਮੇਰੇ ਇੱਕ ਕੁਲੀਗ ਨੇ ਰਕਮੈਂਡ ਕੀਤਾ ਸੀ ਸਰ ਇਸ ਸੈਂਪੂ ਬਾਰੇ ਮੇਰੇ ਦੋਸਤ ਨੇ ਬਿਲਕੁਲ ਠੀਕ ਦੱਸਿਆ ਸੀ ਕਿ ਇਹ ਸ਼ੈਂਪੂ ਇੰਨਾ ਵਧੀਆ ਹੈ ਕਿ ਮੇਰੇ ਵਾਲ ਇਸ ਨਾਲ ਇੰਨੇ ਵਧੀਆ ਹੋ ਗਏ ਕਿ ਜਮਾ ਰੇਸ਼ਮ ਹੋ ਗਏ ਮੇਰੇ ਰੁੱਖੇ ਵਾਲਾਂ ਨੂੰ ਇਸ ਸੈਂਪੂ ਨੇ ਦੋ ਤਿੰਨ ਵਾਰ ਵਰਤਣ 'ਤੇ ਹੀ ਬਹੁਤ ਮੁਲਾਇਮ ਅਤੇ ਚਮਕੀਲਾ ਬਣਾ ਦਿੱਤਾ ਹੋਰ ਤਾਂ ਹੋਰ ਸਰ ਪਹਿਲਾਂ ਮੇਰੇ ਵਾਲ ਬਹੁਤ ਜ਼ਿਆਦਾ ਝੜਦੇ ਸਨ ਇਸ ਸੈਂਪੂ ਦੀ ਵਰਤੋਂ ਨਾਲ ਇਸ ਦੇ ਝੜਨ ਦੀ ਸਮੱਸਿਆ ਤੋਂ ਵੀ ਮੈਨੂੰ ਨਿਜਾਤ ਮਿਲੀ ਹੈ ਮੈਨੂੰ ਇਹ ਸ਼ੈਂਪੂ ਵਰਤਦਿਆਂ ਨੂੰ ਇੱਕ ਮਹੀਨਾ ਹੋ ਗਿਆ ਹੈ ਅਤੇ ਹਾਲੇ ਤਿੰਨ ਮਹੀਨੇ ਇਸ ਸ਼ੀਸ਼ੀ ਨੇ ਹੋਰ ਕੱਢ ਦੇਣੇ ਭਾਵ ਇਹ ਇੰਨਾ ਵਧੀਆ ਹੈ ਕਿ ਇਹ ਬਹੁਤ ਹੀ ਘੱਟ ਮਾਤਰਾ ਵਿੱਚ ਲਗਾਉਣਾ ਪੈਂਦਾ ਹੈ ਅਤੇ ਇਸ ਰੇਟ ਵੀ ਬਿਲਕੁਲ ਵਾਜਬ ਹੈ ਇਸ ਸੈਂਪੂ ਨੂੰ ਰਿਕਮੈਂਡ ਕਰਨ ਵਾਲੇ ਆਪਣੇ ਦੋਸਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਤੁਹਾਡਾ ਵੀ ਇੰਨਾ ਵਧੀਆ ਪ੍ਰੋਡਕਟ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ